ਜ਼ਿੰਦਗੀ ਵਿੱਚ ਕਲਾ ਦੀ ਅਹਿਮੀਅਤ ਆਪਣੀ ਵੱਖਰੀ ਆ ਜ਼ਿੰਦਗੀ ਦੇ ਵਿੱਚ ਕਲਾ ਦੇ ਨਾਲ ਹੀ ਬੰਦਾ ਜੋ ਵਿਅਕਤੀ ਆ ਪ੍ਰੈਕਟੀਕਲੀ ਕਰਨ ਦੇ ਨਾਲ ਬਹੁਤ ਜ਼ਿਆਦਾ ਪ੍ਰਫੁਲਿਤ ਅਤੇ ਅੱਗੇ ਵੱਧਦਾ ਹਰੇਕ ਕੰਮ ਨੂੰ ਜਦੋਂ ਤੁਸੀਂ ਪੜ੍ਹਾਈ ਦੇ ਰੂਪ 'ਚ ਕਰਦੇ ਹੋ ਉਹ ਇੱਕ ਅਲੱਗ ਤਰ੍ਹਾਂ ਦੀ ਆ ਪਰ ਜਦੋਂ ਤੁਸੀਂ ਉਹੀ ਚੀਜ਼ ਨੂੰ ਪ੍ਰੈਕਟੀਕਲ ਆਪਣੇ ਹੱਥ ਦੇ ਨਾਲ ਕਲਾ ਦੇ ਰੂਪ ਵਿੱਚ ਪੇਸ਼ ਕਰਦੇ ਹੋ ਤਾਂ ਉਹ ਜਿਹੜੀ ਚੀਜ਼ ਹੈ ਉਹ ਆਪਣਾ ਇੱਕ ਵੱਖਰਾ ਰੂਪ ਲੈ ਲੈਂਦੀ ਹੈ ਜਿਹਦੇ ਵਿੱਚ ਆਪਾਂ ਨੂੰ ਛੋਟੀਆਂ ਛੋਟੀਆਂ ਬਰੀਕ ਬਰੀਕ ਚੀਜ਼ਾਂ ਜਾਂ ਗੁਣ ਨੇ ਜੋ ਆਪਾਂ ਨੂੰ ਮਿਲਦੇ ਨੇ ਜਿਹੜੇ ਬਹੁਤ ਜ਼ਿਆਦਾ ਜ਼ਰੂਰੀ ਨੇ ਕਲਾ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਮਦਦਗਾਰ ਆ ਹਰੇਕ ਚੀਜ਼ ਨੂੰ ਸੌਖੇ ਤਰੀਕੇ ਦੇ ਨਾਲ ਸਮਝਾਇਆ ਜਾ ਸਕਦਾ ਪ੍ਰੈਕਟੀਕਲੀ ਕਰਕੇ ਕਲਾ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਹਰੇਕ ਵਿਅਕਤੀ ਦੇ ਵਿੱਚ ਕੋਈ ਨਾ ਕੋਈ ਕਲਾ ਜ਼ਰੂਰ ਛੁਪੀ ਹੁੰਦੀ ਆ ਸਿਰਫ ਉਸ ਦੇ ਅੰਦਰ ਇੱਕ ਉਭਾਰਨ ਲਈ ਅੰਦਰੋਂ ਅਤੇ ਇੱਕ ਉਹਦੇ ਬੈਕ 'ਚ ਪ੍ਰੈਸ਼ਰ ਚਾਹੀਦਾ ਹੁੰਦਾ